ਸਰਕਾਰ ਵੱਲੋਂ ਔਰਤਾਂ ਲਈ ਬਹੁਤ ਹੀ ਵਧੀਆ ਸਿਲਾਈ ਸੈਂਟਰ ਖੋਲੇ ਗਏ ਹਨ ਜਿਸ ਵਿੱਚ ਔਰਤਾਂ ਆ ਕੇ ਸਿਲਾਈ ਸਿੱਖਦੀਆਂ ਹਨ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਜਿਸ ਨਾਲ ਉਹਨਾਂ ਉਹ ਆਪਣਾ ਸਵੈ ਰੋਜ਼ਗਾਰ ਚਲਾਉਂਦੀਆਂ ਹਨ ਅਤੇ ਆਪਣੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਨਾਲ ਕਰਦੀਆਂ ਹਨ ਅੱਜ ਦੀ ਸਮੇਂ ਵਿੱਚ ਸਿਲਾਈ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਇਸ ਨਾਲ ਉਹਨਾਂ ਨੂੰ ਬਹੁਤ ਹੀ ਵਧੀਆ ਕਮਾਈ ਹੋ ਰਹੀ ਹੈ ਇਸੇ ਤਰਾਂ ਬਿਊਟੀ ਪਾਰਲਰ ਲਈ ਵੀ ਥਾਂ ਥਾਂ 'ਤੇ ਗੌਰਮੈਂਟ ਵਲੋ ਸਿਖਾਉਣ ਲਈ ਜਿਹੜੀਆਂ ਸੰਸਥਾਵਾਂ ਹਨ ਉਹਨਾਂ ਨੇ ਵੀ ਕੇਂਦਰ ਖੋਲੇ ਹੋਏ ਹਨ ਜਿਸ ਦੌਰਾਨ ਔਰਤਾਂ ਇਹ ਸਿਖਲਾਈ ਲੈ ਕੇ ਆਪਣੇ ਘਰਾਂ ਵਿੱਚ ਵੀ ਇਹ ਕੰਮ ਸ਼ੁਰੂ ਕਰ ਲੈਂਦੀਆਂ ਹਨ ਅਤੇ ਇਹ ਇੱਕ ਥੋੜੀ ਜਿਹੀ ਲਾਗਤ ਨਾਲ ਹੀ ਕੰਮ ਸਟਾਰਟ ਕੀਤਾ ਜਾ ਸਕਦਾ ਹੈ ਅਤੇ ਬਾਅਦ ਵਿੱਚ ਇਸਨੂੰ ਵਧਾਇਆ ਵੀ ਜਾ ਸਕਦਾ ਹੈ ਇਸ ਤਰਾਂ ਸਵੈ ਰੋਜ਼ਗਾਰ ਇੱਕ ਬਹੁਤ ਹੀ ਵਧੀਆ ਗੌਰਮੈਂਟ ਵੱਲੋਂ ਇਹ ਸਿਖਲਾਈ ਦੇ ਕੇ ਔਰਤਾਂ ਲਈ ਕੰਮ ਸ਼ੁਰੂ ਕੀਤਾ ਗਿਆ